ਰਸੋਈਆਂ ਦੇ ਵਿੱਚ ਚੂਹੇ ਕੋਕਰੋਚ ਐਵੇਂ ਦੀ ਚੀਜ਼ਾਂ ਆਮ ਹੀ ਵੇਖਣ ਨੂੰ ਮਿਲ ਜਾਂਦੀਆਂ ਨੇ ਅਤੇ ਇਹਨਾਂ ਤੋਂ ਬਚਣ ਲਈ ਮੈਂ ਇੱਕ ਤਾਂ ਹਿੱਟ ਛਿੜਕਦੀ ਹਾਂ ਟਾਈਮ ਟੂ ਟਾਈਮ ਨੰਬਰ ਦੋ ਰਸੋਈ ਦੇ ਵਿੱਚ ਪੂਰੀ ਤਰ੍ਹਾਂ ਸਫਾਈ ਰੱਖਦੇ ਹਾਂ ਥੱਲੇ ਕੋਈ ਵੀ ਚੀਜ਼ ਨਹੀਂ ਰੱਖੀ ਜਾਂਦੀ ਮਤਲਬ ਕਿ ਧਰਤੀ 'ਤੇ ਲੱਗਦੀ ਹੋਵੇ ਤੇ ਇੱਥੇ ਕੋਈ ਵੀ ਚੀਜ਼ ਨਹੀਂ ਰੱਖੀ ਜਾਂਦੀ ਤਾਂ ਕਿ ਉੱਥੇ ਕੋਕਰੋਚ ਛੁਪ ਕੇ ਨਾ ਬੈਠਣ ਚੂਹੇ ਨਾ ਛੁਪ ਕੇ ਬੈਠਣ ਸਿੱਲਣ ਤੋਂ ਬਚਾਇਆ ਜਾਂਦਾ ਹੈ ਉੱਥੇ ਸਿੱਲ ਨਾ ਹੋਵੇ ਸਿੱਲ ਹੋਣ ਦੇ ਨਾਲ ਵੀ ਚੂਹੇ ਜਿਹੜੇ ਨੇ ਆਮ ਆ ਜਾਂਦੇ ਨੇ ਉਹਨਾਂ ਚੀਜ਼ਾਂ ਤੋਂ ਬਚਾ ਕੇ ਰੱਖਿਆ ਜਾਂਦਾ ਦਸ ਦਿਨਾਂ ਬਾਅਦ ਰਸੋਈ ਦੇ ਡੱਬੇ ਜਿਹੜੇ ਨੇ ਉਹਨਾਂ ਦੀ ਚੰਗੀ ਤਰ੍ਹਾਂ ਸਫਾਈ ਕੀਤੀ ਜਾਂਦੀ ਹੈ ਅੰਦਰੋਂ ਬਾਹਰੋਂ ਫਿਨਾਇਲ ਦੀਆਂ ਗੋਲੀਆਂ ਰੱਖ ਦਿੱਤੀਆਂ ਜਾਂਦੀਆਂ ਨੇ ਵਿੱਚ ਉਹਨਾਂ ਦੀ ਸਮੈਲ ਦੇ ਨਾਲ ਵੀ ਜਿਹੜੇ ਨੇ ਕੋਕਰੋਚ ਵਗੈਰਾ ਨਹੀਂ ਆਉਂਦੇ ਫਿਨਾਇਲ ਦੀਆਂ ਗੋਲੀਆਂ ਸਮੇਂ ਸਮੇਂ 'ਤੇ ਬਦਲਦੇ ਦਸ ਪੰਦਰਾਂ ਦਿਨ ਬਾਅਦ ਉਹਨਾਂ ਨੂੰ ਬਦਲ ਕੇ ਹੋਰ ਰੱਖੀਆਂ ਜਾਂਦੀਆਂ ਨੇ